ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਹੋਰ ਇੱਕ ਜੀ ਆਪਾਂ ਉਹ ਕਰਨੀ ਸੀ ਕੁਐਰੀ ਮੈਂ ਨਾ ਮੈਂ ਲੁਧਿਆਣਾ ਘੁੰਮਣ ਆਉਣਾ ਸੀ ਅਤੇ ਮੇਰੇ ਜਾਣਕਾਰ ਨੇ ਦੱਸਿਆ ਵੀ ਤੁਸੀਂ ਉੱਥੇ ਲੋਕਲ ਹੋ ਅਤੇ ਫਿਰ ਤੁਸੀਂ ਮਤਲਬ ਕਿਸੇ ਦਿਨ ਫਰੀ ਹੋਵੋਂਗੇ ਮੈਨੂੰ ਘੁੰਮਾਉਣ ਵਾਸਤੇ ਮੈਂ ਨੈਕਸਟ ਮੰਥ ਦੇ ਫਸਟ ਵੀਕ 'ਚ ਹੀ ਆਵਾਂਗਾ ਜੀ ਬਾਕੀ ਉਹ ਪਸੰਦ ਮੈਨੂੰ ਤਾਂ ਕੋਈ ਖ਼ਾਸ ਜਾਣਕਾਰੀ ਹੈ ਨਹੀਂ ਪਰ ਤਾਂ ਵੀ ਤੁਸੀਂ ਆਪਣਾ ਜਿਵੇਂ ਕੋਈ ਗੁਰਦੁਆਰੇ ਹੋ ਗਏ ਇੱਥੇ ਅਤੇ ਕੋਈ ਖਾਣ ਪੀਣ ਦੀ ਫੇਮਸ ਜਗ੍ਹਾ ਹੋ ਗਈ ਆਪਣੇ ਨਾਈਟ 'ਚ ਇੰਜੋਏ ਕਰਨ ਲਈ ਹਾਂਜੀ ਅਤੇ ਇਹਦੇ ਬਾਰੇ ਕੁਛ ਦੱਸੋ ਪਹਿਲਾਂ ਗੁਰਦੁਆਰਾ ਸਾਹਿਬ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਬਾਬਾ ਦੀਪ ਸਿੰਘ ਜੀ ਦਾ ਵੀ ਮੈਂ ਸੁਣਿਆ ਜੀ ਇੱਥੇ ਆ ਠੀਕ ਹੈ ਜੀ ਮੈਂ ਘੱਟੋ ਘੱਟ ਜੀ ਤਿੰਨ ਤੋਂ ਚਾਰ ਦਿਨ ਰਹੁੰਗਾ ਉੱਥੇ ਅੱਛਾ ਜੀ ਅੱਛਾ ਇਹ ਆਪਣਾ ਰਹਿਣ ਸਹਿਣ ਦਾ ਪ੍ਰੋਗਰਾਮ ਕਿਵੇਂ ਹੋਵੇਗਾ ਜਰਾ ਉਹ ਵੀ ਦੱਸ ਦਿਓ ਨਹੀਂ ਜੀ ਵੈਸੇ ਦੇਖ ਲਓ ਐਵੇਂ ਜੇ ਕੋਈ ਤੁਹਾਨੂੰ ਪਰੇਸ਼ਾਨੀ ਹੋਵੇਗੀ ਜਿਹੜੀ ਕੋਈ ਹੋਟਲ ਵਗੈਰਾ ਕੋਈ ਤੁਹਾਡੇ ਵਧੀਆ ਪਛਾਣ ਦਾ ਹੋਵੇ ਅੱਛਾ ਜੀ ਅੱਛਾ ਠੀਕ ਹੈ ਫਿਰ ਆਪਾਂ ਉਹਦੀ ਵੀ ਡੇਟ ਫਿਕਸ ਕਰ ਲਾਂਗੇ ਬਾਕੀ ਹਾਂਜੀ ਹਾਂਜੀ ਹਾਂਜੀ ਅਤੇ ਗੁਰਦੁਆਰਾ ਤੋਂ ਸਾਹਿਬ ਅਗਰ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਕੋਈ ਆਪਾਂ ਗੱਲ ਕਰੀਏ ਖਾਣ ਪੀਣੇ ਦੀ ਕੋਈ ਫੇਮਸ ਜਗ੍ਹਾ ਹੋਵੇ ਉਹ ਦੱਸ ਦਿਓ ਆਪਾਂ ਦੋਵੇਂ ਹੀ ਆ ਜੀ ਦੋਨੋਂ 'ਚ ਆ ਜਾਂਦੇ ਆ ਅੱਛਾ ਜੀ ਇਹ ਕਿਹੜੇ ਏਰੀਆ 'ਚ ਪੈਂਦਾ ਅੱਛਾ ਜੀ ਠੀਕ ਹੈ ਜੀ ਇੱਕ ਮੈਂ ਸੁਣਿਆ ਜੀ ਪੰਨੂ ਪਕੌੜਿਆਂ ਵਾਲੇ ਵੀ ਨੇ ਇਥੇ ਬਹੁਤ ਫੇਮਸ ਨੇ ਉਹ ਅੱਛਾ ਜੀ ਅੱਛਾ ਠੀਕ ਹੈ ਜੀ ਜ਼ਰੂਰ ਉਹਦੇ ਵਾਸਤੇ ਤਾਂ ਟਾਈਮ ਕੱਢਿਓ ਜੀ ਆਪਾਂ ਸਾਰੇ ਟਰਾਈ ਕਰਾਂਗੇ ਅਤੇ ਨਹੀਂ ਨਹੀਂ ਮੈਂ ਆਪਣੀ ਕਾਰ 'ਤੇ ਆਊਂਗਾ ਜੀ ਅੱਛਾ ਅਤੇ ਹੋਟਲ ਵਗੈਰਾ 'ਚ ਜੀ ਜ਼ਰੂਰ ਪੱਕਾ ਰੱਖਿਓ ਆਪਣੇ ਕਾਰ ਪਾਰਕਿੰਗ ਵਗੈਰਾ ਦਾ ਵੀ ਹੋਏ ਅਤੇ ਫਿਰ ਚਲੋ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਅਗੇਨ ਕਾਲ ਕਰਾਂਗਾ ਜਦੋਂ ਵੀ ਆਪਣਾ ਪੱਕਾ ਹੋ ਜਾਏਗਾ ਪਲੈਨ ਓਕੇ ਓਕੇ ਠੀਕ ਹੈ ਜੀ